ਮੈਂ ਨਵਾਂਸ਼ਹਿਰ ਵਿੱਚੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਮਤਲਮ ਜੇ ਮੈਂ ਪੰਜਾਬ 'ਚ ਮਤਲਬ ਰਹਿੰਦੀ ਹਾਂ ਤਾਂ ਪੰਜਾਬ ਸ਼ਰ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ ਜਿਵੇਂ ਅਸੀਂ ਖਾਣ ਪੀਣ ਦੀ ਗੱਲ ਕਰੀਏ ਤਾਂ ਕਣਕ ਚੌਲ ਵਗੈਰਾ ਦੀ ਮਤਲਬ ਬਹੁਤ ਹੀ ਹੈਲਪ ਕੀਤੀ ਹੈ ਅਤੇ ਜੇ ਜ ਅਸੀਂ ਹੈਲਥ ਦੀ ਵਰਤੋਂ ਕਰੀਏ ਤਾਂ ਸ ਪੰਜਾਬ ਸਰਕਾਰ ਨੇ ਮਤਲਬ ਬਹੁਤ ਸਾਰੇ ਸ ਹੈਲਥ ਬਾਰੇ ਸਕੀਮਾਂ ਚਲਾਈਆਂ ਹਨ ਜਿਵੇਂ ਕਿ ਹੁਣ ਤਾਂ ਸਾਡੇ ਪਿੰਡ ਆ ਜਾਂਦੀ ਹੈ ਮਤਲਬ ਹੈਲਥ ਮਤਲਬ ਦਵਾਈਆ ਵੰਡਣ ਫ੍ਰੀ ਮੁਫਤ ਦੀਆਂ ਅਤੇ ਸਾਨੂੰ ਪਹਿਲਾਂ ਮਤਲਬ ਮਤਲਬ ਦੂ ਕ ਪਿੰਡ ਤੋਂ ਦੂਰ ਜਾਣਾ ਪੈਂਦਾ ਸੀ ਆਉਣ ਜਾਣ ਤੇ ਬਹੁਤ ਦਿੱਕਤ ਹੁੰਦੀ ਸੀ ਅਤੇ ਸਾਨੂੰ ਮਤਲਬ ਅੱਧਾ ਤਾਂ ਮਤਲਬ ਮਤਲਬ ਬਿਮਾਰੀ ਦੂਰ ਹੀ ਨਹੀਂ ਹੋ ਪਾਉਂਦੀ ਸੀ ਮਤਲਬ ਵਧੀਆ ਸਕੀਮ ਵੀ ਨਹੀਂ ਆਉਂਦਾ ਸਾ ਮਤਲਬ ਵਧੀਆ ਹੈਲਥ ਚੈੱਕਅਪ ਵੀ ਨਹੀਂ ਹੁੰਦੀ ਸੀ ਮਤਲਬ ਹੁਣ ਤਾਂ ਡੋਕਟਰ ਸਾਡੇ ਪਿੰਡ ਆ ਕੇ ਚੈੱਕ ਕਰਦੇ ਹਾਂ ਅਤੇ ਇਸ ਬਾਰੇ ਸਾਨੂੰ ਮਤਲਬ ਆਸ਼ਾ ਵਰਕਰ ਤੋਂ ਪਤਾ ਲੱਗਦਾ ਹੈ ਮਤਲਬ ਜਿਹੜੇ ਹੈਡ ਹੈਲਥ ਵਰਕਰ ਹੁੰਦੇ ਆ ਪਿੰਡ 'ਚ ਹੈਗੇ ਨੇ ਬਹੁਤ ਸਾਰੇ ਉਹਨਾਂ ਬਾਰੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਮਤਲਬ ਇਹਦੇ ਬਾਰੇ ਮੈਨੂੰ ਹੈਲਥ ਬਾਰੇ ਪਤਾ ਲੱਗਦਾ ਹੈ ਅਤੇ ਸਾਨੂੰ ਮਤਲਬ ਬਹੁਤ ਹੀ ਬ ਮਤਲਬ ਬਹੁਤ ਹੀ ਬੈਨੀਫਿਟ ਹੋਇਆ ਹੈ ਮਤਲਬ ਹੈਲਥ ਦੀ ਵਰਤੋਂ ਕਰਕੇ